ਪੰਜਾਬੀ ਜੋ ਕਿ ਪੰਜਾਬ ਦੀ ਭਾਸ਼ਾ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਇਸ ਤੋਂ ਇਲਾਵਾ ਇਹ ਪੰਜਾਬੀ ਆਪਣੀ ਸਰਕਾਰੀ ਭਾਸ਼ਾ ਹੈ ਜੋ ਕੀ ਬਹੁਤ ਜ਼ਰੂਰੀ ਹੁੰਦੀ ਹੈ ਚਾਹੇ ਉਹ ਸਿੱਖਿਆ ਖੇਤਰ ਦੀ ਗੱਲ ਕਰੀਏ ਚਾਹੇ ਉਹ ਕਿਸੀ ਸਰਕਾਰੀ ਜੋਬ ਦੀ ਗੱਲ ਕਰੀਏ ਪੰਜਾਬੀ ਭਾਸ਼ਾ ਹੋ ਅ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਸਿਰਫ ਅੱਜ ਦੇ ਟਾਈਮ ਵਿੱਚ ਇੱਕ ਰਾਜ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਦੇਸ਼ ਵਿੱਚ ਫੈਲ ਚੁੱਕੀ ਹੈ ਹਰ ਕੋਈ ਪੰਜਾਬੀ ਭਾਸ਼ਾ ਬੋਲਣਾ ਪਸੰਦ ਕਰਦਾ ਹੈ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਜੋ ਪੰਜਾਬ ਦੇ ਲ ਰਹਿਣ ਵਾਲੇ ਨਿਵਾਸੀ ਹਨ ਉਹ ਪੰਜਾਬੀ ਭਾਸ਼ਾ ਵਿੱਚ ਬੋਲ ਕੇ ਆਪਣੀ ਗੱਲਬਾਤ ਕਰਦੇ ਹਨ ਇੱਕ ਦੂਸਰੇ ਨਾਲ ਆਪਣੀ ਗੱਲਬਾਤ ਨੂੰ ਪਹੁੰਚਾਉਂਦੇ ਹਨ ਅਤੇ ਆਪਣੇ ਭਾਈਚਾਰੇ ਆਪਣੇ ਸੱਭਿਆਚਾਰ ਨੂੰ ਵੀ ਬਦਾਵਾ ਦਿੰਦੇ ਹਨ ਜਿਵੇਂ ਕਿ ਮੈਂ ਗੱਲ ਕਰਾਂ ਬਹੁਤ ਸਾਰੀ ਹੋਰ ਭਾਸ਼ਾਵਾਂ ਹਨ ਜੋ ਹਿੰਦੀ ਅੰਗਰੇਜ਼ੀ ਅਤੇ ਉਰਦੂ ਵਿੱਚੋਂ ਚ ਲਈ ਗਈ ਹੈ ਪਰ ਪੰਜਾਬੀ ਜੋ ਹੈ ਅੱਜ ਦੇ ਸਮੇਂ ਵਿੱਚ ਸਪੇਨ ਅਤੇ ਡੱਚ ਭਾਸ਼ਾਵਾਂ ਵਿੱਚੋਂ ਵੀ ਲਈ ਜਾ ਰਹੀ ਹੈ ਜਿਵੇਂ ਕਿ ਲੋਕ ਅੱਜ ਦੇ ਸਮੇਂ ਵਿੱਚ ਦੂਸਰੇ ਖੇ ਸ਼ਹਿਰਾਂ ਵਿੱਚ ਜਾਂ ਦੇਸ਼ਾਂ ਵਿੱਚ ਜਿਵੇਂ ਕਿ ਕੈਨੇਡਾ ਆਸਟ੍ਰੇਲੀਆ ਅਤੇ ਅਮੈਰੀਕਾ ਜਾ ਰਹੇ ਹਨ ਪਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪੰਜਾਬੀ ਅੱਜ ਦੇ ਸਮੇਂ ਵਿੱਚ ਕੈਨੇਡਾ ਵਰਗੇ ਦੇਸ਼ਾਂ ਵਿੱਚ ਪੰਜਵੇਂ ਨੰਬਰ 'ਤੇ ਬੋਲੀ ਜਾਣ ਵਾਲੀ ਭਾਸ਼ਾ ਹੋ ਰਹੀ ਹੈ